ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵਧੀਆ ਸ਼ਮਾ ਹੋ ਜਾਂਦਾ ਜੀ ਕੋਈ ਗੱਲ ਨਹੀਂ ਦੱਸੋ ਫਿਰ ਤੁਸੀਂ ਕਰ ਤਾ ਲਈ ਸੀ ਮੈਂ ਕਿਹਾ ਧੂੜ ਲੱਗੀ ਆ ਬੜੀ ਵਧੀਆ ਚਲੋ ਠੀਕ ਹੈ ਉਹ ਨਹੀਂ ਲਾ ਲਾਂਗੇ ਜੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕਿਚਨ ਦਾ ਕਿਚਨ ਦਾ ਤਾਂ ਜੇ ਕੰਮ ਵਧਦਾ ਵਾ ਉਹ ਲੰਬਾ ਕੰਮ ਹੈ ਥੋੜ੍ਹਾ ਜਿਹਾ ਅਤੇ ਨਹੀਂ ਛੋਟਾ ਕਿੱਦਾ ਹੋਉਂਗਾ ਹਾਂ ਕੋਈ ਨਹੀਂ ਲਾ ਦਿੰਦੇ ਹਾਂ ਲਾ ਦਿਆਂਗੇ ਲਾ ਦਿਆਂਗੇ ਲਾ ਦਿਆਂਗੇ ਦੱਸ ਗਿਆ ਸੀ ਮੈਂ ਵੈਸੇ ਦੱਸ ਤਾਂ ਗਿਆ ਸੀ ਅਤੇ ਚਲੋ ਕੰਮ ਕਰ ਰਿਹਾ ਨਾ ਮੈਂ ਹਜੇ ਤਾਂ ਮੈਂ ਕਰ ਰਿਹਾ ਨਿਊ ਅੰਮ੍ਰਿਤਸਰ ਹਾਂ ਹਾਂ ਹਾਂ ਹਾਂਜੀ ਹਾਂਜੀ ਕੋਈ ਨਹੀਂ ਕਰ ਦਿੰਦੇ ਠੀਕ ਹੈ ਜੀ ਓਕੇ ਜੀ